ਰਾਜ ਦੀ ਅਮੀਰ ਸੱਭਿਆਚਾਰਿਕ ਵਿਭਿੰਨਤਾ ਦਾ ਅਨੁਭਵ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਲਈ ਕੁਝ ਵਿਲਕਪ ਇਹੀ ਹਨ ਜਿਵੇਂ ਕਿ ਕਬਾਇਲੀ ਪਿੰਡਾਂ ਦਾ ਦੌਰਾ ਕਰਨਾ ਅਤੇ ਸਥਾਨਕ ਭਾਈਚਾਰਾ ਨਾਲ ਗੱਲਬਾਤ ਕਰਨਾ ਜਿਵੇਂ ਕਿ ਸੈਲਾਨੀ ਬਾਹਰੋਂ ਆਉਂਦੇ ਹਨ ਅਤੇ ਉਹ ਪਿ ਸ਼ਹਿਰਾਂ ਸ਼ਹਿਰਾਂ ਵਿੱਚ ਘੁੰਮ ਕੇ ਚਲ ਜਾਂਦੇ ਹਨ ਪਰ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਉਹਨਾਂ ਨੂੰ ਪਿੰਡਾਂ ਵਿੱਚ ਵੀ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਅਮੀਰ ਘਰ ਵਿੱਚ ਜਾਂਦੇ ਹਾਂ ਅਤੇ ਉਹ ਸਾਨੂੰ ਇੱਜ਼ਤ ਮਾਣ ਨਹੀਂ ਦਿੰਦੇ ਜਿਸ ਇਸ ਲਈ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਜਿਵੇਂ ਆਪਾਂ ਕਿ ਪ ਪਿੰਡਾਂ ਦੇ ਘਰ ਜਾਵਾਂਗੇ ਅਤੇ ਉਹ ਸਾਨੂੰ ਬਹੁਤ ਇੱਜ਼ਤ ਮਾਣ ਦੇਣਗੇ ਅਤੇ ਜਿਵੇਂ ਕਿ ਸ ਜਿਵੇਂ ਸੈਲਾ ਫੋਰਨ ਪਿੰਡਾਂ ਵਿੱਚ ਜਾਣ 'ਤੇ ਉਹਨਾਂ ਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਕਿ ਕੋਈ ਘਰ ਦੀਆਂ ਜ ਜਨਾਨੀਆਂ ਉਹਨਾਂ ਦੇ ਉਹ ਕਲਾ ਕਰਦੀਆਂ ਹੁੰਦੀਆਂ ਜਿਵੇਂ ਉਹ ਘਰ ਵਿੱਚ ਮਟਕੇ ਬਣਾਉਂਦੀਆਂ ਹੁੰਦੀਆਂ ਹਨ ਇਸ ਲਈ ਸਾਨੂੰ ਇਹ ਵੀ ਪਛ ਜਾਣਨਾ ਚਾਹੀਦਾ ਹੈ ਕਿ ਪਿੰਡਾਂ ਵਿੱਚ ਕੀ ਕੀ ਹੋ ਰਿਹਾ ਇਸ ਲਈ ਸਾਨੂੰ ਹਮੇਸ਼ ਪਿੰਡਾਂ ਵਿੱਚ ਜਾਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਵੀ ਆਪਣੇ ਇਤਿਹਾਸ ਪੁਰਾਣੇ ਇਤਿਹਾਸ ਬਾਰੇ ਪਤਾ ਲੱਗੇ ਅਤੇ ਅਸੀਂ ਸਾਨੂੰ ਹੁਣ ਤਾਂ ਇਹ ਜਮਾਨੇ ਵਿੱਚ ਖ਼ਤਮ ਹੋ ਚੁੱਕੇ ਹਨ ਜਿਵੇਂ ਮਟਕੇ ਹੈਂ ਸ਼ਹਿਰਾਂ ਵਿੱਚ ਤਾਂ ਖ਼ਤਮ ਹੋ ਚੁੱਕੇ ਹਨ ਪਰ ਜੇ ਆਪਾਂ ਪਿੰਡਾਂ ਵਿੱਚ ਜਾਈਏ ਹਜੇ ਵੀ ਮੀਨਿੰਗ ਚੱਲਦੇ ਪਏ ਹਨ ਜਿਵੇਂ ਕਿ ਮਟਕੇ ਹੋ ਗਏ ਹੋਰ ਮੰਜੇ ਹੋ ਗਏ ਆ ਲੱਕੜ ਦੇ ਮੰਜੇ ਹੋ ਗਏ ਇਹ ਚੀਜ਼ਾਂ ਚੱਲਦੀਆਂ ਪਈਆਂ ਹਨ ਇਸ ਲਈ ਸਾਨੂੰ ਹਮੇਸ਼ਾ ਹੀ ਅ ਜ ਪਿੰਡਾਂ ਵਿੱਚ ਜਾ ਕੇ ਦੇਖਣਾ ਚਾਹੀਦਾ ਹੈ ਕਿ ਉਹ ਕੀ ਹੋ ਰਿਹਾ ਹੈ ਉੱਥੇ ਥੈਂਕ ਯੂ